ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਪਰਮਜੀਤ ਕੌਰ ਹੈ ਮੈਂ ਖਰੜ ਤੇ ਬੋਲਦੀ ਹਾਂ ਤੁਸੀਂ ਭੈਣਾਂ ਦੇ ਢਾਬੇ ਤੋਂ ਬੋਲਦੇ ਹਾਂਜੀ ਜੀ ਸਾਡੇ ਘਰ ਨਾ ਇੱਕ ਪ੍ਰੋਗਰਾਮ ਹੈ ਅਤੇ ਮੈਂ ਖਾਣ ਲਈ ਔਡਰ ਕਰਨਾ ਸੀ ਹਾਂਜੀ ਜੀ ਤੁਹਾਡਾ ਨੈੱਟ 'ਤੇ ਮੈਂ ਨੰਬਰ ਲਿਆ ਜੀ ਅਤੇ ਤੁਹਾਡਾ ਖਾਣਾ ਬਹੁਤ ਵਧੀਆ ਏ ਰੇਟਿੰਗ ਵੀ ਮੈਂ ਵਧੀਆ ਦੇਖੀ ਬਹੁਤ ਵਧੀਆ ਰੇਟਿੰਗ ਚੱਲ ਰਹੀ ਹੈ ਤੁਹਾਡੀ ਅਤੇ ਮੈਂ ਤੁਹਾਨੂੰ ਖਾਣੇ ਲਈ ਔਡਰ ਕਰਨਾ ਸੀ ਤੁਸੀਂ ਮੈਨੂੰ ਮੈਂ ਤੁਹਾਨੂੰ ਦੱਸਦੀ ਹਾਂ ਜੀ ਕੀ ਔਡਰ ਕਰਨਾ ਸੀ ਇੱਕ ਦਾਲ ਮੱਖਣੀ ਇਕ ਸ਼ਾਹੀ ਪਨੀਰ ਇੱਕ ਮਿਕਸ ਵੈੱਜ ਇੱਕ ਸਿੰਪਲ ਰਾਈਤਾ ਇੱਕ ਬੂੰਦੀ ਰਾਈਤਾ ਇੱਕ ਪਾਈਨਐਪਲ ਰਾਈਤਾ ਇੱਕ ਹਾਂਜੀ ਇੱਕ ਹਲਵਾ ਇੱਕ ਹਲਵਾ ਕਰ ਦਿਓ ਇੱਕ ਗੁਲਾਬ ਜਾਮਣ ਕਰ ਦਿਓ ਇੱਕ ਸ ਮੂੰਗੀ ਦਾ ਹਲਵਾ ਕਰ ਦਿਓ ਇਕ ਗਾਜਰ ਪਾਕ ਹਾਂਜੀ ਹਾਂਜੀ